ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨੀਰੂ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅੱਜ ਮੈਂ ਆਪਣੇ ਸ ਸਿਲਾਈ ਅਤੇ ਬੁਣਾਈ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੀ ਹਾਂ ਐ ਐਹ ਮੇਰੇ ਸਿਲਾਈ ਓਰ ਬੁਣਾਈ ਮੈਨੂੰ ਸਿਲਾਈ ਦਾ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਕਾਫੀ ਮੈਨੂੰ ਸ਼ੌਕ ਸੀ ਇਸ ਸ ਕਿਉਂਕਿ ਮੇਰੇ ਮੰਮੀ ਸਿਲਾਈ ਦਾ ਕੰਮ ਕਰਦੇ ਸੀ ਔਰ ਬੁਣਾਈ ਦਾ ਵੀ ਸਵੈਟਰ ਵਗੈਰਾ ਵੀ ਉਹ ਬਣਾਉਂਦੇ ਸੀ ਇਸ ਕਰਕੇ ਮੈਨੂੰ ਬਹੁਤ ਹੀ ਵਧੀਆ ਮਤਲਬ ਕਿ ਮੈਂ ਵੀ ਉਹੀ ਕੰਮ ਵਿੱਚ ਮਤਲਬ ਕਿ ਮੈਂ ਪੈ ਗਈ ਮੈਨੂੰ ਅੱਜ ਮਤਲਬ ਕਿ ਮੈਂ ਸਿਲਾਈ ਦਾ ਵੀ ਕਾਫੀ ਕੰਮ ਕੀਤਾ ਔਰ ਮੈਂ ਬੁਟੀਕ ਵੀ ਆਪਣੀ ਮਤਲਬ ਕਿ ਸ਼ੁਰੂ ਕੀਤੀ ਅੱਜ ਵੀ ਮੈਂ ਮਤਲਬ ਕਿ ਹਾਲੇ ਤੱਕ ਵੀ ਮੈਂ ਆਪਣੇ ਮਤਲਬ ਕਿ ਕੱਪੜੇ ਖੁਦ ਹੀ ਸਟਿਚਿੰਗ ਕਰਦੀ ਹਾਂ ਔਰ ਕਾਫੀ ਲੋਕ ਆ ਜਿਹੜੇ ਮੇਰੇ ਤੋਂ ਮਤਲਬ ਕਿ ਸਟਿਚਿੰਗ ਕਰਵਾਉਂਦੇ ਹੈ ਔਰ ਮੈਂ ਮਤਲਬ ਕਿ ਬੁਣਾਈ ਦਾ ਮੈਨੂੰ ਬਚਪਨ ਕਾਫੀ ਦੇਰ ਤੋਂ ਸ਼ੌਂਕ ਸੀ ਜਿਸ ਵਿੱਚ ਮੈਂ ਆਪਣੀ ਮੰਮੀ ਤੋਂ ਹੀ ਇਹ ਸਾਰਾ ਮੈਂ ਜਾਚ ਸਿੱਖੀ ਔਰ ਮੈਂ ਅੱਜ ਮਤਲਬ ਕਿ ਮਤਲਬ ਕਾਫੀ ਦੁਕਾਨਦਾਰਾਂ ਦੇ ਹੋਰ ਘਰਾਂ ਦੇ ਕਾਫੀ ਸਵੈਟਰ ਮਤਲਬ ਕਿ ਮੈਂ ਬਣਾਏ ਮਤਲਬ ਹੁਣ ਤੱਕ ਵੀ ਮੈਂ ਕਾਫੀ ਬੱਚਿਆਂ ਦੇ ਸਵੈਟਰ ਵਗੈਰਾ ਜੋ ਵੀ ਸਭ ਕੁਛ ਮਤਲਬ ਕਿ ਮੈਂ ਸਿਲਾਈ ਮਤਲਬ ਮਤਲਬ ਬਹੁਤ ਹੀ ਵਧੀਆ ਮੈਨੂੰ ਕੀ ਹੈ ਕੰਮ ਲੱਗਿਆ ਮੈਂ ਹਾਲੇ ਵੀ ਇਹੀ ਕੰਮ ਕਰਦੀ ਹਾਂ ਬੁਣਾਈ ਦਾ ਕੰਮ ਵੀ ਮੈਂ ਕਰਦੀ ਹਾਂ ਸਿਲਾਈ ਦਾ ਵੀ ਕਰਦੀ ਹਾਂ ਦੋਨੋਂ ਹੀ ਕੰਮ ਮੈਂ ਕਰਦੀ ਹਾਂ ਮੈਂ ਦੇ ਮਤਲਬ ਕਿ ਕਾਫੀ ਮੇਰੇ ਦੇਖ ਕੇ ਮੈਨੂੰ ਕਾਫੀ ਰੋਜ਼ੀ ਪ੍ਰਾਪਤ ਹੋਈ ਅਤੇ ਮਤਲਬ ਕਿ ਮੈਨੂੰ ਕਾਫੀ ਅੱਛਾ ਮਹਿਸੂਸ ਹੋਇਆ ਕਿ ਮਤਲਬ ਕਿ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ ਇਸ ਕਰਕੇ ਮਤਲਬ ਮੈਂ ਇਹ ਕੰਮ ਸ਼ੁਰੂ ਕੀਤਾ ਜਿਸ ਕਰਕੇ ਮਤਲਬ ਕਿ ਮੈਨੂੰ ਅਜੇ ਵੀ ਮਤਲਬ ਸਿਲਾਈ ਦਾ ਕੰਮ ਤਾਂ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਔਰ ਬੁਣਾਈ ਦਾ ਕੰਮ ਵਿੱਚ ਤਾਂ ਮੈਂ ਕਾਫੀ ਅਕਸਪਰਟ ਹਾਂ ਲੋਕ ਕਾਫੀ ਦੂਰ ਦੂਰ ਤੋਂ ਮੇਰੇ ਕੋਲ ਮਤਲਬ ਕਿ ਸਵੈਟਰ ਵਗੈਰਾ ਸੈਟ ਹੋ ਗਈ ਹੋਰ ਵੀ ਕਈ ਮਤਲਬ ਲੈ ਕਿ ਆਂਉਦੇ ਜੋ ਕਿ ਮੈਂ ਉਹਨਾਂ ਨੂੰ ਤਿਆਰ ਕਰਕੇ ਅੱਛੀ ਮਤਲਬ ਮਤਲਬ ਡਿਜ਼ਾਇਨ ਦੇ ਨਾਲ ਉਹਨੂੰ ਤਿਆਰ ਕਰਦੀ ਹਾਂ ਔਰ ਉਹਨਾਂ ਨੂੰ ਮੈਂ ਦਿੰਦੀ ਹਾਂ ਉਹ ਵੀ ਮਤਲਬ ਦੇ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਕਿ ਮਤਲਬ ਕਿ ਮੇਰੇ ਹੱਥ ਦੀ ਸਫਾਈ ਇਹਨੂੰ ਕਾਫੀ ਪ੍ਰਸ਼ੰਸਾ ਕਰਦੇ ਹੈ ਮਤਲਬ ਬਹੁਤ ਹੀ ਵਧੀਆ ਤਰੀਕੇ ਨਾਲ ਮੈ ਕਰਦੀ ਹਾਂ ਇਸ ਕਰ ਕਰਕੇ ਮਤਲਬ ਕਿ ਸਿਲਾਈ ਵੀ ਮਤਲਬ ਮੈਨੂੰ ਬਹੁਤ ਹੀ ਦਿਲਚਸਪੀ ਹੈ ਹਾਲੇ ਤੀਕਰ ਵੀ ਮੈਂ ਕਾਫੀ ਮਤਲਬ ਕਿ ਇਸ ਕੰਮ ਨੂੰ ਮੈਂ ਕਰਦੀ ਹਾਂ ਸਿਲਾਈ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਸਿਲਾਈ ਦਾ ਮੈਂ ਬਹੁਤ ਹੀ ਵਧੀਆ ਡਿਜ਼ਾਈਨਰ ਕੱਪੜੇ ਸੀ ਲੈਂਦੀ ਆ ਔਰ ਮਤਲਬ ਕਿ ਕਾਫੀ ਲੋਕ ਮੇਰੇ ਤੋਂ ਸਿਲਾਈ ਦੇ ਕੱਪੜੇ ਮਤਲਬ ਕਿ ਸਵਾਉਂਦੇ ਹੈ ਅੱਛੇ ਤਰੀਕੇ ਦੇ ਨਾਲ ਮਤਲਬ ਸਟਿਚਿੰਗ ਕਰਦੀ ਹਾਂ ਬਹੁਤ ਹੀ ਪਸੰਦ ਕਰਦੇ ਹੈ ਲੋਕ ਮਤਲਬ ਸਚਿਚਿੰਗ ਮਤਲਬ ਕਾਫੀ ਮਤਲਬ ਕਿ ਅੱਛੇ ਤਰ੍ਹਾਂ ਦੇ ਮੈਂ ਸੂਟ ਹਰ ਹਰ ਤਰ੍ਹਾਂ ਦਾ ਡਿਜ਼ਾਇਨ ਹਰ ਤਰ੍ਹਾਂ ਦਾ ਮਤਲਬ ਕਿ ਕੱਪੜਾ ਮਤਲਬ ਕਿ ਮੈਂ ਸਿਲਾਈ ਤਿਆਰ ਕਰ ਸਕਦੀ ਹਾਂ ਔਰ ਕਰਦੀ ਵੀ ਹਾਂ ਕਾਫੀ ਲੋਕ ਮਤ ਮਤਲਬ ਕਿ ਪਸੰਦ ਕਰਦੇ ਹੈ ਮੇਰੀ ਸਿਲਾਈ ਨੂੰ ਔਰ ਮੇਰੀ ਬੁਣਾਈ ਨੂੰ ਬੁਣਾਈ ਤੋਂ ਮੈਨੂੰ ਬਹੁਤ ਹੀ ਵਧੀਆ ਮਤਲਬ ਕਿ ਮੈਂ ਕਰਦੀ ਹਾਂ ਅਜੇ ਤੀਕਰ ਵੀ ਮੈਂ ਮਤਲਬ ਕਿ ਮਤਲਬ ਉਹ ਕੰਮ ਨੂੰ ਨਹੀਂ ਛੱਡ ਪਾ ਰਹੀ ਕਿਉਂਕਿ ਮੈਨੂੰ ਇੰਨੀ ਦਿਲਚਸਪੀ ਹੈ ਇਸ ਕੰਮ ਵਿੱਚ ਸਿਲਾਈ ਔਰ ਬੁਣਾਈ ਦਾ ਕਾਫੀ ਮਤਲਬ ਕਿ ਲੋਕ ਮੇਰੇ ਤੋਂ ਹਾਲੇ ਵੀ ਸਵੈਟਰ ਬਣਾਉਣ ਲਈ ਆਉਂਦੇ ਹੈ ਅੱਛੇ ਅੱਛੇ ਡਿਜ਼ਾਇਨ ਮਤਲਬ ਕਿ ਮੈਂ ਤਿਆਰ ਕਰਦੀ ਹਾਂ ਕਾਫੀ ਮਤਲਬ ਵਧੀਆ ਤਰੀਕੇ ਦੇ ਨਾਲ ਓਰ ਭਾਵ ਮਤਲਬ ਕਿ ਬਹੁਤ ਮੈਂ ਜਿੰਨੀ ਵੀ ਇਸ ਚੀਜ਼ ਦੀ ਪ੍ਰਸ਼ੰਸਾ ਕਰਾਂ ਬਹੁਤ ਘੱਟ ਹੈ ਕਿਉਂਕਿ ਮੈਨੂੰ ਇਹ ਦੋਨੋਂ ਹੀ ਚੀਜ਼ ਬਹੁਤ ਹੀ ਸ਼ੌਕ ਮੇਰੇ ਅੰਦਰ ਇੱਕ ਪੈਦਾ ਹੋਇਆ ਸੀ ਕਿ ਮੈਂ ਇਹ ਕਰਨਾ ਕਿਉਂਕਿ ਮੇਰੇ ਆਪਣੇ ਮੰਮੀ ਨੂੰ ਦੇਖ ਕੇ ਹੀ ਇਹ ਸਭ ਮਤਲਬ ਕਿ ਕੰਮ ਮੈਨੂੰ ਅੱਛਾ ਲੱਗਿਆ ਔਰ ਮਤਲਬ ਕਿ ਖੁਦ ਮੈਂ ਮੇਰਾ ਮਨ 'ਚ ਮਤਲਬ ਕਿ ਇੱਕ ਹਿੰਮਤ ਜੀ ਪੈਦਾ ਹੋਈ ਕਿ ਹਾਂ ਜੀ ਇਹ ਮੈਂ ਕੰਮ ਕਰ ਸਕਦੀ ਹਾਂ ਔਰ ਅੱਜ ਦੇ ਟਾਈਮ ਵਿੱਚ ਵੀ ਮੈਂ ਕੰਮ ਕਰਦੀ ਹਾਂ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਂ ਇਹੀ ਕਹਿਣਾ ਚਾਹੂੰਗੀ ਕਿ ਅੱਜ ਦੇ ਟਾਈਮ ਵਿੱਚ ਹਰ ਕਿਸੇ ਲੜਕੀ ਨੂੰ ਸਿਲਾਈ ਔਰ ਬੁਣਾਈ ਦਾ ਕੰਮ ਆਉਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਹੀ ਵਧੀਆ ਕੰਮ ਹੈ ਔਰ ਮੈਂ ਬਸ ਜੀ ਬਸ ਇੰਨਾ ਹੀ ਕਹਿਣਾ ਚਾਵਾਂਗੀ ਬਸ ਥੈਂਕ ਯੂ ਜੀ